ਮੈਨੂੰ ਕਈ ਤਰ੍ਹਾਂ ਦੇ ਪਕਵਾਨ ਬਣਾਉਣਾ ਆਉਂਦਾ ਹੈ ਅਤੇ ਮੈਂ ਪਕਵਾਨ ਬਣਾਉਣ 'ਚ ਬਹੁਤ ਹੀ ਵਧੀਆ ਮਹਿਸੂਸ ਕਰਦੀ ਹਾਂ ਅਤੇ ਮੈਨੂੰ ਪਕਵਾਨ ਬਣਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਕ ਹੈ ਪਕਵਾਨ ਬਣਾਉਣ ਦਾ ਆਪਣਾ ਆਪਣਾ ਅਲੱਗ ਅਲੱਗ ਢੰਗ ਹੈ ਜਿਵੇਂ ਕਿ ਮੈਂ ਮੈਗੀ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਲੈਂਦੀ ਹਾਂ ਉਹ ਪੰਜ ਮਿੰਟ 'ਚ ਬਣ ਜਾਂਦਾ ਹੈ ਅਤੇ ਮੈਨੂੰ ਸਭ ਤੋਂ ਆਸਾਨ ਲੱਗਦਾ ਹੈ ਅਤੇ ਮੈਨੂੰ ਜੇ ਗੱਲ ਕਰੀਏ ਔਖੇ ਦੀ ਤਾਂ ਔਖਾ ਮੈਨੂੰ ਸਾਗ ਲੱਗਦਾ ਹੈ ਜਿੱਦਾਂ ਪਹਿਲਾਂ ਉਹਨੂੰ ਕੱਟਣਾ ਪੈਂਦਾ ਹੈ ਫਿਰ ਕੁੱਕਰ 'ਚ ਉਬਾਲਣਾ ਪੈਂਦਾ ਹੈ ਉਬਾਲਣ ਲਈ ਤਾਂ ਮਤਲਬ ਦੋ ਤਿੰਨ ਘੰਟੇ ਲੱਗ ਜਾਂਦੇ ਹੈ ਉਸ ਤੋਂ ਬਾਅਦ ਪਿਆਜ਼ ਲਸਣ ਵਗੈਰਾ ਕੱਟੋ ਉਹਦੇ ਮਸਾਲੇ ਦੀ ਤਿਆਰੀ ਕਰੋ ਫਿਰ ਉਹਨੂੰ ਤੜਕਾ ਮਾਰੋ ਸਾਗ ਬਣਾਉਣ 'ਚ ਇੱਕ ਦਿਨ ਪੂਰਾ ਹੀ ਲੱਗ ਜਾਂਦਾ ਹੈ ਮੇਰੇ ਘਰ 'ਚ ਵੀ ਬਣਾਉਂਦੇ ਹੈ ਮੇਰੇ ਮੰਮੀ ਉਹ ਜਦ ਵੀ ਬਣਾਉਂਦੇ ਹੈ ਸਾਨੂੰ ਬਹੁਤ ਹੀ ਟਾਈਮ ਲੱਗ ਜਾਂਦਾ ਹੈ ਅਤੇ ਜਦ ਮੈਂ ਮੈਨੂੰ ਬਹੁਤ ਹੀ ਜ਼ਿਆਦਾ ਔਖਾ ਲੱਗਦਾ ਹੈ ਕਈ ਵਾਰੀ ਮੈਨੂੰ ਜੇ ਕਹਿ ਦਿੰਦੇ ਹੈ ਬਣਾਉਣ ਨੂੰ ਤਾਂ ਮੈਨੂੰ ਇਹ ਬਹੁਤ ਹੀ ਔਖਾ ਲੱਗਦਾ ਹੈ ਮੈਗੀ ਮੈਂ ਸਭ ਤੋਂ ਸੌਖਾ ਸੋਚਦੀ ਹਾਂ ਕਿ ਸੌਖਾ ਕੰਮ ਹੈ ਅਤੇ ਸਾਗ ਬਣਾਉਣ 'ਚ ਮੈਨੂੰ ਬਹੁਤ ਹੀ ਜ਼ਿਆਦਾ ਔਖਾ ਲੱਗਦਾ ਹੈ ਸਭ ਤੋਂ ਔਖਾ ਪਕਵਾਨ ਸਾਗ ਹੀ ਲੱਗਦਾ ਹੈ ਮੈਨੂੰ ਮੈਂ ਸਾਗ ਬਣਾਉਣਾ ਬਿਲਕੁਲ ਵੀ ਪਸੰਦ ਨਹੀਂ ਕਰਦੀ ਜ਼ਿਆਦਾ ਤੋਂ ਜ਼ਿਆਦਾ ਇਹ ਟਾਈਮ ਲੈਂਦਾ ਹੈ ਅਤੇ ਬਹੁਤ ਹੀ ਜ਼ਿਆਦਾ ਟਾਈਮ ਲੱਗ ਜਾਂਦਾ ਇੱਕ ਦਿਨ ਤੋਂ ਇੱਕ ਦਿਨ ਤਾਂ ਪੂਰਾ ਹੀ ਲੱਗ ਜਾਂਦਾ ਹੈ ਬਣਾਉਣ 'ਚ ਅਤੇ ਬਹੁਤ ਹੀ ਆਸਾਨ ਵੀ ਨਹੀਂ ਹੈ ਅਤੇ ਸਭ ਤੋਂ ਜ਼ਿਆਦਾ ਔਖਾ ਹੈ